ਨਮਸਕਾਰ ਜੀ ਮੈਂ ਮੈਂ ਤੁਹਾਡੇ ਹੋਟਲ ਦੇ ਵਿੱਚ ਆਉਂਦੀ ਆਉਂਦੀ ਰਹਿੰਦੀ ਹਾਂ ਮੈਨੂੰ ਤੁਹਾਡਾ ਹੋਟਲ ਬੜਾ ਚੰਗਾ ਲੱਗਦਾ ਹੈ ਇਹ ਇੱਥੋਂ ਦਾ ਖਾਣਾ ਕੀ ਬਹੁਤ ਸੁਆਦ ਹੁੰਦਾ ਹੈ ਮੈਂ ਆਪਣੇ ਦੋਸਤਾਂ ਨੂੰ ਪਰਿਵਾਰ ਵਾਲਿਆਂ ਨੂੰ ਇੱਥੇ ਲੈ ਕੇ ਆਉਂਦੀ ਹਾਂ ਹਾਂਜੀ ਮੈਂ ਚਾਹੁੰਦੀ ਹਾਂ ਮੈਨੂੰ ਆਪਣੇ ਹੋਟਲ ਦੀ ਕੋਈ ਵਧੀਆ ਜਿਹੀ ਡਿਸ਼ ਖੁਆਓ ਮੈਂ ਇਹ ਵੀ ਪੁੱਛਣਾ ਚਾਹੁੰਦੀ ਹਾਂ ਜੇ ਮੈਂ ਆਉਣਾ ਹੋਵੇ ਤੁਹਾਡੇ ਹੋਟਲ ਦੇ ਵਿੱਚ ਕੋਈ ਡਾਂਸ ਸੰਗੀਤ ਕਾਰਿਆਕ੍ਰਮ ਹੈ ਜੇ ਮੈਂ ਕਿਸੇ ਦੇ ਨਾਲ ਆਉਣਾ ਹੋਵੇ ਤਾਂ ਬੁਕਿੰਗ ਹੋ ਜਾਵੇਗੀ ਮੈਂ ਤੁਹਾਡੀ ਪਾਸ ਪੇਸ਼ਕਸ਼ ਮੈਂ ਕਰਨਾ ਚਾਹੁੰਦੀ ਹਾਂ ਵੇਖਣਾ ਚਾਹੁੰਦੀ ਹਾਂ ਤੋ ਉਸ ਦਾ ਅਨੰਦ ਲੈਣਾ ਚਾਹੁੰਦੀ ਹਾਂ ਨਾਨੀ ਨਾਲ ਹੀ ਤੁਹਾਡਾ ਕੋਈ ਤੁਹਾਡਾ ਚੰਗਾ ਕੋਈ ਪੋਰਸ਼ਨ ਖਾਣਾ ਵੀ ਚਾਹੁੰਦੀ ਹਾਂ ਵੇਖਣਾ ਵੀ ਚਾਹੁੰਦੀ ਹਾਂ ਸਭ ਕੁਛ ਕਰਨਾ ਚਾਹੁੰਦੀ ਹਾਂ